ਜਿਹੜੀ ਅੱਜ ਤੋਂ ਪਹਿਲੀ ਪੀੜ੍ਹੀ ਸੀ ਮਨ ਲਉ ਆਪਣੇ ਦਾਦਿਆਂ ਦੀ ਪਿਉਆਂ ਦੀ ਪੀੜ੍ਹੀ ਸੀ ਇਨ੍ਹਾਂ ਨੇ ਨਾ ਆਪਣੇ ਸਮਿਆਂ ਵਿੱਚ ਹਲ਼ਾਂ ਨਾਲ ਖੇਤੀ ਕੀਤੀ ਆ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਸ ਲਈ ਇਹ ਚਾਹੁੰਦੇ ਹਨ ਵੀ ਜਿਹੜੇ ਸਾਡੇ ਬੱਚੇ ਆ ਸਾਡੇ ਵਾਂਗ ਮਿਹਨਤ ਕਰਨ ਸਾਡੇ ਵਾਂਗ ਕੰਮ ਕਰਨ ਖੇਤਾਂ ਖੇਤੀ ਦਾ ਕੰਮ ਕਰਨ ਖੇਤਾਂ ਵਿੱਚ ਕੰਮ ਕਰਨ ਕਿਉਂ ਮਿਹਨਤ ਦੀ ਫਲ ਮਿੱਠਾ ਹੁੰਦਾ ਹੈ ਪਰ ਜਿਵੇਂ ਜਿਵੇਂ ਯੁੱਗ ਬਦਲ ਰਿਹਾ ਤਾਂ ਟੈਕਨੋਲਜੀ ਬਦਲ ਰਹੀ ਹੈ ਬੱਚੇ ਇੱਦਾਂ ਕਹਿੰਦੇ ਹਨ ਸਾਨੂੰ ਹਾਰਡ ਵਰਕ ਨਾਲੋਂ ਸਮਾਰਟ ਵਰਕ ਜ਼ਿਆਦਾ ਕਰਨਾ ਚਾਹੀਦਾ ਹੈ ਵੀ ਕੰਮ ਕਰੋ ਚੰਗੇ ਤਰੀਕੇ ਨਾਲ ਸੌਖੇ ਸੁਖਾਲੇ ਤਰੀਕੇ ਨਾਲ ਕੰਮ ਕਰੋ ਜਿਵੇਂ ਕਿ ਹੁਣ ਪਹਿਲਾਂ ਹਲਦਾਂ ਦੀ ਜਗ੍ਹਾ ਹਲ਼ਾਂ ਹਲ਼ਾਂ ਦੀ ਜਗ੍ਹਾ ਆਪਣੇ ਟਰੈਕਟਰਾਂ ਨੇ ਲੈ ਲਈ ਇਸੇ ਤਰੀਕੇ ਨਾਲ ਬਹੁਤ ਫਰਕ ਪੈਂਦਾ ਜਾ ਰਿਹਾ ਸੋਚ ਸੀ ਪੁਰਾਣੇ ਬਜ਼ੁਰਗਾਂ ਦੀ ਕਿ ਆਪਣਾ ਪਿੰਡਾਂ ਵਿੱਚ ਪਿੰਡਾਂ ਤੱਕ ਸੀਮਤ ਰਹਿੰਦੇ ਸੀ ਹੁਣ ਤਾਂ ਦੁ ਦੁਨੀਆਂ ਚੰਦ 'ਤੇ ਪਹੁੰਚ ਗਈ ਹੈ ਨਵੀਂ ਪੀੜ੍ਹੀ ਦੀ ਸੋਚ ਵੀ ਉੱਦਾਂ ਹੀ ਬਦਲਦੀ ਜਾ ਰਹੀ ਹੈ ਸੋ ਇਸ ਦਾ ਜਿਹੜਾ ਅੰਤਰ ਹੈ ਵੀ ਅੱਜ ਦੇ ਸਮੇਂ ਵਿੱਚ ਸਾਨੂੰ ਨਾ ਵੀ ਹਾਰਡ ਵਰਕ ਨਾਲੋਂ ਥੋੜ੍ਹਾ ਸਮਾਰਟ ਵਰਕ ਕਰਨਾ ਚਾਹੀਦਾ ਹੈ ਵੀ ਸਾਨੂੰ ਦੇਖ ਕੇ ਚੱਲਣਾ ਚਾਹੀਦਾ ਹੈ ਵੀ ਕਿਸ ਚੀਜ਼ ਦੀ ਕਿਹੜੀ ਡਿਮਾਂਡ ਹੈ ਕੀ ਕੰਮ ਸਾਨੂੰ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ